ਅੱਜ ਤੋਂ ਦੋ ਸਾਲ ਪਹਿਲਾਂ ਮੈਂ ਇੱਕ ਔਨਲਾਈਨ ਪ੍ਰੈੱਸ ਮੰਗਵਾਈ ਸੀ ਜੋ ਕਿ ਬਹੁਤ ਹੀ ਵਧੀਆ ਚੱਲਦੀ ਹੈ ਹੁਣ ਮੇਰੇ ਵੱਡੇ ਵੀਰ ਨੇ ਸਟੱਡੀ ਕਰਨ ਲਈ ਹੋਸਟਲ ਵਿੱਚ ਜਾਣਾ ਹੈ ਮੈਂ ਸੇਮ ਪ੍ਰੈੱਸ ਔਨਲਾਈਨ ਉਸਨੂੰ ਮੰਗਵਾ ਕੇ ਦਿੱਤੀ ਪ੍ਰੰਤੂ ਉਹ ਪ੍ਰੈੱਸ ਇੱਕ ਦਿਨ ਬਾਅਦ ਹੀ ਖਰਾਬ ਹੋ ਗਈ ਅਤੇ ਕੱਪੜੇ ਚੱਕਣ ਲੱਗ ਗਈ ਮੇਰਾ ਔਨਲਾਈਨ ਸ਼ੋਪਿੰਗ ਤੋਂ ਵਿਸ਼ਵਾਸ ਉੱਠ ਗਿਆ ਅਤੇ ਮੈਂ ਆਪਣੇ ਬ੍ਰਦਰ ਨੂੰ ਨਾਲ ਲੈ ਕੇ ਬਜ਼ਾਰ ਤੋਂ ਜਾ ਕੇ ਪ੍ਰੈਸ ਲੈ ਕੇ ਆਇਆ ਅਤੇ ਉਹਨਾਂ ਨੇ ਗਰੰਟੀ ਦਿੱਤੀ ਇਸ ਕਰਕੇ ਮੈਂ ਕਹਿੰਦਾ ਵੀ ਔਨਲਾਈਨ ਸ਼ੋਪਿੰਗ ਤੋਂ ਕੋਈ ਵੀ ਚੀਜ਼ ਨਹੀਂ ਮੰਗਵਾਉਣੀ ਚਾਹੀਦੀ ਨਾ ਹੀ ਉਸ ਦੀ ਕੋਈ ਗਰੰਟੀ ਹੁੰਦੀ ਹੈ ਜਦੋਂ ਅਸੀਂ ਬਜ਼ਾਰ ਤੋਂ ਜਾ ਕੇ ਪ੍ਰੈੱਸ ਲੈ ਕੇ ਆਏ ਉਸ ਦੀ ਗਰੰਟੀ ਵੀ ਦਿੱਤੀ ਅਤੇ ਉਹ ਬਹੁਤ ਹੀ ਵਧੀਆ ਚੱਲ ਰਹੀ ਹੈ